ਰੂਪਨਗਰ ਜ਼ਿਲ੍ਹੇ ਦੇ ਵਿੱਚ ਹਾਊਸਿੰਗ ਵਿਕਲਪ ਦਾ ਕਾਫੀ ਪ੍ਰਬੰਧ ਹੈ ਅਤੇ ਇਸ ਦੇ ਨਾਲ ਨਾਲ ਹਾਊਸਿੰਗ ਮਾਰਕਿਟ ਅਤੇ ਰੀਅਲ ਅਸਟੇਟ ਦਾ ਵੀ ਕਾਫੀ ਪ੍ਰਬੰਧ ਕੀਤਾ ਗਿਆ ਹੈ ਅਲੱਗ ਅਲੱਗ ਕਲੋਨੀਆਂ ਦੇ ਵਿੱਚ ਛੋਟੇ ਹਾਊਸ ਛੋਟੇ ਸੈੱਟ ਬਣੇ ਹੋਏ ਨੇ ਜਿਹੜੇ ਕਿ ਛੋਟੇ ਪਰਿਵਾਰਾਂ ਦੇ ਲਈ ਕਾਫੀ ਜਾਇਜ਼ ਰੇਟਾਂ ਦੇ ਉੱਤੇ ਉਪਲੱਬਧ ਹਨ ਜਿਵੇਂ ਕਿ ਆਮ ਤੌਰ 'ਤੇ ਦੇਖਿਆ ਜਾਵੇ ਕਿ ਇੱਥੇ ਆਪਣੇ ਰੋਪੜ ਜ਼ਿਲ੍ਹੇ ਦੇ ਵਿੱਚ ਆਈ ਆਈ ਟੀ ਹੋ ਗਈ ਜਾਂ ਸਨ ਫਾਰਮਾ ਜਾਂ ਸਵਰਾਜ ਵਰਗੀਆਂ ਅਜਿਹੀਆਂ ਕੰਪਨੀਆਂ ਨੇ ਜਿੱਥੇ ਕਿ ਕੰਮ ਕਰਨ ਅਤੇ ਸਿੱਖਿਆ ਲੈਣ ਲਈ ਕਾਫੀ ਲੋਕ ਦੂਰੋਂ ਆਉਂਦੇ ਨੇ ਤਾਂ ਉਨ੍ਹਾਂ ਦੇ ਲਈ ਵੀ ਰਿਹਾਇਸ਼ ਦੇ ਤੌਰ 'ਤੇ ਰੋਪੜ ਜਿਲ੍ਹੇ ਦੇ ਵਿੱਚ ਕਾਫੀ ਛੋਟੇ ਹੋਮ ਸੈੱਟ ਜਾਂ ਕਹਿ ਲਈਏ ਵੀ ਹਾਊਸ ਸੈੱਟ ਬਣੇ ਹੋਏ ਨੇ ਜਿਨ੍ਹਾਂ ਦੇ ਨਾਲ ਜਿਹੜੀ ਬਾਹਰ ਦੀ ਜਨਤਾ ਜਾਂ ਕਹਿ ਲਈਏ ਬਾਹਰ ਦੇ ਲੋਕ ਨੇ ਜੋ ਇੱਥੇ ਕੰਮ ਕਰਨ ਆਉਂਦੇ ਨੇ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਇੱਥੇ ਉਨ੍ਹਾਂ ਨੂੰ ਬਣੇ ਬਣਾਏ ਘਰ ਜਾਂ ਬਣੇ ਬਣਾਏ ਸਟੋਰੀ ਸੈੱਟ ਮਿਲ ਜਾਂਦੇ ਨੇ